ਮੇਰੇ ਪਿੰਡ ਵਿੱਚ ਡਾਂਸ ਬਹੁਤ ਜ਼ਰੂਰੀ ਹੈ ਇਹ ਲੋਕਾਂ ਨੂੰ ਇਕੱਠਾ ਲਿਆਉਂਦੇ ਲਿਆਉਂਦਾ ਹੈ ਖੁਸ਼ੀ ਪੈਦਾ ਕਰਦਾ ਹੈ ਅਤੇ ਸਮੁਦਾਇਕ ਸੱਭਿਆਚਾਰ ਨੂੰ ਮਜ਼ਬੂਤ ਕਰਦਾ ਹੈ ਲੋਕ ਵਿਸ਼ੇਸ਼ ਤਿਉਹਾਰਾਂ 'ਤੇ ਜਾਂ ਸਮਾਰੋਹਾਂ 'ਚ ਪਰੰਪਰਾਇਕ ਨਾਚ ਨੱਚ ਜਾਂ ਮਾਡਰਨ ਡਾਂਸ ਵੇਖਦੇ ਅਤੇ ਕਰਦੇ ਹਨ ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਆਪਸ ਵਿੱਚ ਜੁੜਨ ਦਾ ਤਰੀਕਾ ਵੀ ਹੈ ਪਿੰਡ ਵਿੱਚ ਡਾਂਸ ਦੇ ਮਹੱਤਵ ਨੂੰ ਸਮਝਣਾ ਇੱਕ ਖਾਸ ਅਨੁਭਵ ਹੈ ਇਹ ਇਹ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸੰਸਕ੍ਰਿਤਿਕ ਪਹਿਛਾਣ ਦਾ ਇੱਕ ਹਿੱਸਾ ਵੀ ਹੈ ਸੰਪਰਕ ਅਤੇ ਯਾਦਾਂ ਡਾਂਸ ਸਮਾਜਿਕ ਸਮਾਗਮਾਂ ਦਾ ਹਿੱਸਾ ਹੁੰਦਾ ਹੈ ਜਿਵੇਂ ਕਿ ਵਿਆਹ ਤਿਉਹਾਰ ਅਤੇ ਮੌਕਿਆਂ 'ਤੇ ਇੱਥੇ ਲੋਕ ਇਕੱਠੇ ਹੁੰਦੇ ਹਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵਕਤ ਬਿਤਾਉਂਦੇ ਹਨ ਜੋ ਇੱਕ ਦੂਜੇ ਨਾਲ ਸੰਪਰਕ ਮਜ਼ਬੂਤ ਕਰਦਾ ਹੈ ਪਰੰਪਰਾਵਾਂ ਬਹੁਤ ਸਾਰੇ ਪਿੰਡਾਂ ਵਿੱਚ ਪਰੰਪਰਾਇਕ ਡਾਂਸ ਰਵਾਇਤਾਂ ਹਨ ਜੋ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲਦੀਆਂ ਹਨ ਇਹਨਾਂ ਵਿੱਚ ਲੋਕਾਂ ਦੀ ਸੰਸਕ੍ਰਿਤੀ ਇਤਿਹਾਸ ਅਤੇ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਹਨ ਉਦਾਹਰਨ ਵਜੋਂ ਪੰਜਾਬੀ ਬੋਲੀਆਂ ਵਿੱਚ ਭੰਗੜਾ ਅਤੇ ਗਿੱਧਾ ਬਹੁਤ ਹੀ ਪ੍ਰਸਿੱਧ ਹਨ ਖੁਸ਼ੀ ਅਤੇ ਮਨੋਰੰਜਨ ਡਾਂਸ ਸਿਰਫ ਰੀਤੀ ਰਿਵਾਜ ਦਾ ਹਿੱਸਾ ਨਹੀਂ ਸਗੋਂ ਲੋਕਾਂ ਦੀਆਂ ਖੁਸ਼ੀਆਂ ਦਾ ਪ੍ਰਤੀਕ ਵੀ ਹੈ ਡਾਂਸ ਕਰਨ ਨਾਲ ਲੋਕਾਂ ਨੂੰ ਆਨੰਦ ਅਤੇ ਮੌਜ ਮਸਤ ਕਰਨ ਦਾ ਮੌਕਾ ਮਿਲਦਾ ਹੈ ਜੋ ਉਸ ਸਮੇਂ ਦੇ ਸਟਰੈਸ ਨੂੰ ਭੁਲਾ ਦਿੰਦਾ ਹੈ ਸਿੱਖਣਾ ਅਤੇ ਵਿਕਾਸ ਬੱਚੇ ਅਤੇ ਨੌਜਵਾਨ ਡਾਂਸ ਸਿੱਖ ਕੇ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ ਇਸ ਨਾਲ ਉਹਨਾਂ ਨੂੰ ਸਰੀਰਕ ਫਿਟਨੈਸ ਸੰਗੀਤ ਦੇ ਨਾਲ ਗਤੀਵਿਧੀ ਅਤੇ ਸਹਿਯੋਗ ਸਿੱਖਣ ਦਾ ਮੌਕਾ ਮਿਲਦਾ ਹੈ ਸਮਾਜਿਕ ਏਕਤਾ ਡਾਂਸ ਸਿਰਫ ਇੱਕ ਕਲਾ ਨਹੀਂ ਇਹ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦਾ ਮਾਧਿਅਮ ਹੈ ਲੋਕ ਜਦੋਂ ਇਕੱਠੇ ਨੱਚਦੇ ਹਨ ਤਾਂ ਉਹਨਾਂ ਵਿੱਚ ਭਾਈਚਾਰਾ ਅਤੇ ਮਿੱਤਰਤਾ ਦਾ ਅਹਿਸਾਸ ਵਧਦਾ ਹੈ